ਹੈਲੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਉਹਦੀ ਸਜਾਵਟ ਕਰੋ ਤੁਸੀਂ ਕੋਈ ਜਿਸ ਤਰ੍ਹਾਂ ਹੈ ਨਾ ਬਾਹਰਲੀ ਸਾਈਡ ਪਾਰਕ ਹੋਏਗਾ ਕਿਉਂਕਿ ਮੈਡਮ ਉਹਦੇ ਵਿੱਚ ਆਪਾਂ ਕੋਈ ਵੀ ਸਜਾਵਟ ਕਰ ਸਕਦੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਹੋਰ ਮੈਡਮ ਆਪਾਂ ਸਾਈਡ 'ਤੇ ਮਟਕੇ ਵਗੈਰਾ ਰੱਖ ਸਕਦੇ ਹਾਂ ਸਟੋਨ ਨੂੰ ਵਗੈਰਾ ਲਗਾ ਕੇ ਕੋਈ ਕੋਈ ਆਪਾਂ ਸਜਾਵਟ ਕਰ ਸਕਦੇ ਹਾਂ

ਹਾਂਜੀ ਪੇਂਟ ਕਰਕੇ ਰੱਖ ਸਕਦੇ ਹਾਂ ਉਹਨਾਂ ਨੂੰ ਜੋੜ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਉਹ ਫਿਰ ਅਸੀਂ ਆਵਾਂਗੇ ਨਾ ਤੁਹਾਡੇ ਘਰ ਅਤੇ ਦੇਖਾਂਗੇ ਅਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਰਨਾ ਕਿਉਂਕਿ ਮੈਡਮ ਇਹ ਚੀਜ਼ਾਂ ਹੁਣ ਫੋਨ 'ਤੇ ਤਾਂ ਤੁਹਾਨੂੰ ਮੈਂ ਨਹੀਂ ਦੱਸ ਸਕਦੀ ਨਾ ਆਪਾਂ ਉਹ ਜਗ੍ਹਾ ਵੇਖ ਕੇ ਕਿਸ ਤਰ੍ਹਾਂ ਦੀ ਹੈ ਤੁਹਾਡੇ ਹੈ ਨਾ ਘਰ ਦੀ ਬਾਹਰਲੀ ਸਾਈਡ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਮੈਮ ਤੁਸੀਂ ਭਾਵੇਂ ਨਕਸ਼ਾ ਭੇਜ ਦਿਓ ਜਾਂ ਅਸੀਂ ਆ ਕੇ ਦੇਖ ਕੇ ਤੁਹਾਨੂੰ ਸਾਰਾ ਕੁਝ ਦੱਸ ਦਵਾਂਗੇ ਕਿ ਆਹ ਚੀਜ਼ ਇੱਥੇ ਵਧੀਆ ਲੱਗੇਗੀ ਆਹ ਚੀਜ਼ ਦੀ ਇੱਥੇ ਸਜਾਵਟ ਕਰੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਉਹੀ ਨਾ ਮੈਂ ਮਹਿਮਾਨ ਵੀ ਆਉਣ ਤਾਂ ਆਪਾਂ ਬਾਹਰ ਬਿਠਾ ਸਕਦੇ ਹਾਂ ਥੋੜ੍ਹਾ ਸਜਾਵਟ ਹੋਏ ਤਾਂ ਵਧੀਆ ਲੱਗਦਾ ਘਰ ਹਾਂਜੀ ਠੀਕ ਹੈ ਮੈਮ ਕੋਈ ਨਾ ਜੀ ਘਰ ਆ ਕੇ ਫਿਰ ਹੀ ਕਰਾਂਗੇ ਗੱਲ ਠੀਕ ਹੈ ਓਕੇ ਜੀ